ਰਵਾਇਤੀ ਪਕਵਾਨ ਵਿੱਚ ਸਾਡੇ ਖੇਤਰ ਵਿੱਚ ਖੀਰ ਪੂੜੇ ਬਣਾਏ ਜਾਂਦੇ ਹਨ ਜੋ ਕਿ ਸਾਵਣ ਦੇ ਮਹੀਨੇ ਵਿੱਚ ਬਣਾਏ ਜਾਂਦੇ ਹਨ ਇਸ ਨੂੰ ਬਣਾਉਣ ਲਈ ਦੁੱਧ ਅਤੇ ਚੌਲਾਂ ਦੀ ਜ਼ਰੂਰਤ ਪੈਂਦੀ ਹੈ ਆਟੇ ਵਿੱਚ ਗੁੜ ਪਾ ਕੇ ਪਾਣੀ ਵਿੱਚ ਘੋਲਿਆ ਜਾਂਦਾ ਹੈ ਫਿਰ ਤਵੇ 'ਤੇ ਪਾ ਕੇ ਬੋੜ੍ਹ ਦੇ ਪੱਤਿਆਂ ਨਾਲ ਬਣਾਏ ਜਾਂਦੇ ਹਨ ਅਤੇ ਇਸ ਨੂੰ ਤੇਲ ਲਗਾ ਕੇ ਤੇਲ ਲਗਾ ਕੇ ਬਣਾਇਆ ਜਾਂਦਾ ਹੈ ਇਹ ਬਹੁਤ ਸਵਾਦ ਬਣਦੇ ਹਨ ਹਨ ਇਹ ਮੀ ਆਪਾਂ ਮੀਂਹ ਦੇ ਮੋਸਮ ਵਿੱਚ ਵੀ ਬਣਾ ਕੇ ਖਾ ਸਕਦੇ ਹਾਂ ਬਾਸੜੀ ਦਾ ਤਿਓਹਾਰ ਮਨਾਉਣ ਲਈ ਰਾਤ ਨੂੰ ਗੁਲਗੁਲੇ ਬਣਾਏ ਜਾਂਦੇ ਹਨ ਇਹ ਗੁੜ ਦੀ ਵਰਤੋਂ ਨਾਲ ਹੀ ਬਣਾਏ ਜਾਂਦੇ ਹਨ ਅਤੇ ਇਸਦੇ ਵਿੱਚ ਆਪਾਂ ਸੌਂਫ ਵਗੈਰਾ ਪਾ ਕੇ ਵੀ ਬਣਾ ਸਕਦੇ ਹਾਂ ਪਕੌੜੇ ਜਦੋਂ ਕਿਸੇ ਦੇ ਵਿਆਹ ਜਨਮਦਿਨ ਜਾਂ ਮੀਂਹ ਪੈਂਦਾ ਹੋਵੇ ਤਦ ਪਕੌੜੇ ਬਣਾਏ ਜਾਂਦੇ ਹਨ